ਪੰਜਾਬ ਦੇ ਵਿੱਚ ਹੁਣ ਜਿਹੜੀ ਚੱਲ ਰਹੀ ਆ ਮੁੱਖ ਮੰਤਰੀ ਕੈਂਸਰ ਰਾਹਤ ਕੁਛ ਯੋਜਨਾ ਗੀ ਜਿਹਦੇ ਵਿੱਚ ਕਿ ਡੇਢ ਲੱਖ ਰੁਪਇਆ ਗਾ ਜਿਹੜਾ ਕੈਂਸਰ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਦਿੱਤਾ ਜਾਂਦਾ ਨਹੀਂ ਤਾਂ ਕਿ ਉਹਨਾਂ ਦੀ ਫਾਇਨੈਸ਼ੀਅਲ ਹੈਲਪ ਹੋ ਸਕੇ ਅਤੇ ਜਿਹੜੀ ਦੂਸਰੀ ਸਕੀਮ ਆ ਉਹ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਗੀ ਇਹਦੇ ਵਿੱਚ ਕੀ ਹੈਗਾ ਕਿ ਜਿਹੜੇ ਜਿਨ੍ਹਾਂ ਕੋਲ ਨੀਲੇ ਕਾਰਡ ਨੇ ਉਹਨਾਂ ਨੂੰ ਪੰਜਾਹ ਹਜ਼ਾਰ ਰੁਪਇਆ ਉਹਨਾਂ ਦੀ ਮਾਲੀ ਮਦਦ ਲਈ ਦਿੱਤਾ ਜਾਂਦਾ ਜੇਕਰ ਕਿਸੇ ਵੀ ਮੈਂਬਰ ਦੀ ਮੌਤ ਹੋ ਜਾਂਦੀ ਹੈ ਕਿਸੇ ਵੀ ਐਕਸੀਡੈਂਟ ਦੇ ਵਿੱਚ ਮੁਖੀ ਦੀ ਜੇਕਰ ਉਹਨਾਂ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਰਹਿ ਗਿਆ ਜਾਂ ਉਹਨੂੰ ਕੋਈ ਡਿਸਬਿਲਿਟੀ ਹੋ ਜਾਂਦੀ ਆ ਤਾਂ ਉਹਦੇ ਲਈ ਕੀ ਹੈਗਾ ਤਾਂ ਪੰਜ ਲੱਖ ਦੀ ਸਹਾਇਤਾ ਗੀ ਜਿਹੜੀ ਸਰਕਾਰ ਦੇ ਦੁਆਰਾ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੇ ਸਾਨੂੰ ਕੋਈ ਐਮਰਜੈਂਸੀ ਆ ਤਾਂ ਸਾਡੇ ਕੋਲ ਫਰੀ ਐਂਬੂਲੈਂਸ ਦੀ ਸਹੂਲਤ ਉਪਲੱਬਧ ਹੈਗੀ ਜਿਹੜੀ ਕਿ ਅਸੀਂ ਇੱਕ ਸੌ ਅੱਠ ਨੰਬਰ 'ਤੇ ਕੋਲ ਕਰਕੇ ਮੰਗਵਾ ਸਕਦੇ ਹਾਂ ਅਤੇ